ਅਠਾਰ੍ਹਾਂ ਇੱਕ ਉੱਨੀ ਸੌ ਚੁਰਾਨਵੇਂ ਵੀਹ ਦਸ ਉੱਨੀ ਸੌ ਤ੍ਰਿਆਨਵੇਂ ਬਾਰ੍ਹਾਂ ਦਸ ਦੋ ਹਜ਼ਾਰ ਸੋਲ੍ਹਾਂ ਅੱਠ ਉੱਨੀ ਸੌ ਪਚਾਨਵੇਂ ਅੱਠ ਪੰਜ ਦੋ ਹਜ਼ਾਰ ਦਸ